ਮੈਂ ਆਪਣੇ ਘਰ ਵਿੱਚ ਹੀ ਖਾਣਾ ਖੁਦ ਹੀ ਬਣਾਉਂਦੀ ਹਾਂ ਮੈਂ ਇਸ ਵਿੱਚ ਕਈ ਹੀ ਪਰੰਪਰਾਵਾਂ ਹੁੰਦੀਆਂ ਹਨ ਮੈਂ ਵਾਹਿਗੁਰੂ ਦਾ ਨਾਂ ਲੈ ਕੇ ਹੀ ਖਾਣਾ ਖਾਂਦੀ ਹਾਂ ਕਈ ਤਾਂ ਅੰਧ ਵਿਸ਼ਵਾਸ ਵਿੱਚ ਹੀ ਜੁੜੇ ਹੋਏ ਹਨ ਉਹ ਖਾਣੇ ਨੂੰ ਮੱਥਾ ਟੇਕ ਕੇ ਖਾਂਦੇ ਹਨ ਖਾਂਦੇ ਹਨ ਕਿ ਮੈਂ ਤਾਂ ਰੱਬ ਦਾ ਨਾਂ ਲੈ ਕੇ ਹੀ ਖਾਂਦੀ ਹਾਂ ਅੰਧ ਵਿਸ਼ਵਾਸ ਨਾਲ ਲੋਕ ਜੁੜੇ ਹਨ ਕਿ ਮੱਥਾ ਟੇਕ ਕੇ ਰੋਟੀ ਖਾਂਦੇ ਹਨ ਰੋਟੀ ਖਾਂਦੇ ਹਨ ਕਿ ਇਹ ਮੈਂ ਅੰਧ ਵਿਸ਼ਵਾਸ 'ਤੇ ਯਕੀਨ ਨਹੀਂ ਕਰਦੀ ਇਹ ਤਾਂ ਕਈ ਤਰ੍ਹਾਂ ਦੀਆਂ ਅੰਧ ਵਿਸ਼ਵਾਸਾਂ ਹਨ ਮੈਂ ਇਸ ਪਰ ਵਿਸ਼ਵਾਸ ਨਹੀਂ ਕਰਦੀ ਮੈਂ ਤਾਂ ਹਰ ਵਾਰੀ ਰੋਟੀ ਰੱਬ ਦਾ ਨਾਂ ਲੈ ਕੇ ਹੀ ਖਾਂਦੀ ਹਾਂ ਮੈਨੂੰ ਸਮਝ ਨਹੀਂ ਆਉਂਦੀ ਲੋਕ ਮੱਥਾ ਟੇਕ ਕੇ ਰੋਟੀ ਕਿਉਂ ਖਾਂਦੇ ਹਨ ਅਸੀਂ ਤਾਂ ਆਪਣੇ ਹੱਕ ਦੀ ਕਮਾ ਕੇ ਖਾਂਦੇ ਹਾਂ ਸਾਨੂੰ ਇੰਝ ਨਹੀਂ ਕਰਨਾ ਚਾਹੀਦਾ ਸਾਨੂੰ ਅੰਧ ਵਿਸ਼ਵਾਸ ਨਾਲ ਨਹੀਂ ਜੁੜਨਾ ਚਾਹੀਦਾ ਸਾਨੂੰ ਆਪਣੇ ਹੱਕ ਦੀ ਰੋਟੀ ਖਾਣ ਲਈ ਮੱਥਾ ਅੰਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਪਰੰਪਰਾਵਾਂ ਤਾਂ ਕਈ ਚੱਲਦੀਆਂ ਆ ਰਹੀਆਂ ਹਨ ਪਰ ਸਾਨੂੰ ਰੱਬ ਦਾ ਨਾਂ ਲੈ ਕੇ ਖਾਣਾ ਖਾਣਾ ਚਾਹੀਦਾ ਹੈ